ਹਰਿਆ ਭਰਿਆ ਅਤੇ ਸਾਫ਼ ਵਾਤਾਵਰਣ ਵਾਸਤੇ ਅਸੀਂ ਕਾਫ਼ੀ ਕੁਛ ਕਰ ਸਕਦੇ ਹਾਂ ਜਿੱਦਾਂ ਪੇੜ ਪੌਦੇ ਹੋਰ ਲਾਉਣਾ ਜਾਂ ਫਿਰ ਗੰਦਗੀ ਘ ਘਟਾਉਣੀ ਅਤੇ ਹੋਰ ਵੀ ਕਾਫ਼ੀ ਚੀਜ਼ਾਂ ਹੈਗੀਆਂ ਜਿੱਦਾਂ ਆਹ ਮੈਂ ਮਨ੍ਹਾ ਨਹੀਂ ਕਰ ਸਕਦਾ ਕਿ ਸਾਨੂੰ ਲੱਕੜ ਵਗੈਰਾ ਚਾਹੀਦੀ ਨਹੀਂ ਹੈਗੀ ਤਾਂ ਸਾਨੂੰ ਚਾਹੀਦੀ ਹੈਗੀ ਤਾਂ ਸਾਨੂੰ ਕੱਟਣਾ ਪੈਂਦਾ ਹੈ ਕਾਫ਼ੀ ਪੇੜ ਵਗੈਰਾ ਪਰ ਅਸੀਂ ਆਹ ਕਰ ਸਕਦੇ ਹਾਂ ਕਿ ਇੱਕ ਪੇੜ ਨੂੰ ਕੱਟਣ ਤੋਂ ਬਾਅਦ ਘੱਟ ਤੋਂ ਘੱਟ ਦਸ ਜਾਂ ਬਾਰ੍ਹਾਂ ਹੋਰ ਪੇੜ ਨਵੇਂ ਬੀਜ ਲਾਈ ਜਾਵੇ ਤਾਂ ਕਿ ਅੱਗੇ ਆਉਣ ਵਾਲੀ ਜੇਨੇਰੇਸ਼ਨ ਵਾਸਤੇ ਵੀ ਸ ਸੁਖੀ ਰਹੇ ਅਤੇ ਉਨ੍ਹਾਂ ਨੂੰ ਵੀ ਸਾਰੀ ਹਰਿਆਲੀ ਵੇਖਣ ਨੂੰ ਮਿਲੇ ਕਿ ਜਿੱਦਾਂ ਦੇ ਹਾਲਾਤ ਹੈਗੇ ਹ ਇਸ ਵੇਲੇ ਸਾਡੀ ਅਗਲੀ ਜੈਨਰੇਸ਼ਨ ਨੂੰ ਕਾਫ਼ੀ ਸਾਰੇ ਜੀਵ ਜੰਤੂ ਅਤੇ ਹੋਰ ਪੇੜਾਂ ਵਗੈਰਾ ਉਸ ਚੀਜ਼ਾਂ ਵੇਖਣ ਨੂੰ ਨਹੀਂ ਮਿਲ ਸਕਦੀਆਂ ਪਰ ਅਸੀਂ ਆਹ ਸਭ ਕੁਛ ਕਰ ਸਕਦੇ ਹਾਂ ਜਿੱਦਾਂ ਹੋਰ ਪੇੜ ਲਾਉਣਾ ਹਰਿਆਲੀ ਵਗੈਰਾ ਰੱਖਣੀ ਜਿਹਦੇ ਨਾਲ ਲੋਕ ਹੋਰ ਤੋਂ ਹੋਰ ਪ੍ਰਭਾਵਿਤ ਵੀ ਹੋਣ ਅਤੇ ਨਾਲ ਨਾਲ ਹੋਰ ਕੰਮ ਵੀ ਕਰਨ ਅਤੇ ਹਾਂ ਸੈਰ ਸਪਾਟਿਆਂ ਤੋਂ ਕਾਫ਼ੀ ਲੋਕ ਪ੍ਰਭਾਵਿਤ ਹੋਏ ਹਨ ਜਿਵੇਂ ਉਨ੍ਹਾਂ ਨੇ ਜਦੋਂ ਪਾਣੀ ਵਗੈਰਾ ਸਾਫ਼ ਕੀਤਾ ਜਾਂ ਪਾਣੀ ਵਗੈਰਾ ਸਾਫ਼ ਕਰਨ ਵਾਸਤੇ ਐਕਟ ਕੱਢਿਆ ਜਾਂ ਫਿਰ ਪੇੜਾਂ ਨੂੰ ਨਾ ਕੱਟਣ ਵਾਸਤੇ ਐਕਟ ਕੀਤਾ ਕੁਛ ਪੇੜਾਂ ਉੱਤੇ ਨੰਬਰ ਲੇਤਾ ਕਿ ਉਹ ਪੇੜ ਕੱਟਣ ਤੋਂ ਬਿਲਕੁਲ ਹੀ ਮਨ੍ਹਾ ਹਨ ਤਾਂ ਕਿ ਹਰਿਆਲੀ ਬਣੀ ਵੀ ਰਹੇ ਇੱਦਾਂ ਨਹੀਂ ਕਿ ਜ਼ਿਆਦਾ ਤੋਂ ਜ਼ਿਆਦਾ ਲੱਕੜ ਹੀ ਕੱਟੀ ਜਾਵੀਏ ਅਤੇ ਸਿਰਫ਼ ਬੀਜ ਬੋਈ ਜਾਵੇ ਸਾਡਾ ਸਾਰਾ ਪੇੜ ਪੌਦੇ ਉੜ ਜਾਵਣ ਬਸ ਅੱਗੇ ਆਉਣ ਵਾਲੀ ਜੈਨਰੇਸ਼ਨ ਵਾਸਤੇ ਰਹਿਣ ਇੱਦਾਂ ਵੀ ਨਹੀਂ ਕਰਨਾ ਨਾ ਅਤੇ ਕੁਛ ਪੇੜ ਸਾਡੇ ਵਾਸਤੇ ਰੱਖਣੇ ਵੀ ਹੈਗੇ ਅਤੇ ਉਨ੍ਹਾਂ ਉੱਤੇ ਨੰਬਰ ਵਗੈਰਾ ਲਾਏ ਜਾਂਦੇ ਹੈ ਜਿੱਦਾਂ ਜਿਨ੍ਹਾਂ ਦੇ ਨਾਲ ਉਹ ਪੇੜ ਸਪੈਸ਼ਲੀ ਗੌਰਮੈਂਟ ਵੱਲੋਂ ਪ੍ਰੋਟੈਕਟਡ ਹੈਗੇ ਹੈ ਆਹ ਚੀਜ਼ਾਂ ਕਰਕੇ ਲੋਕ ਵੀ ਪ੍ਰਭਾਵਿਤ ਹੋਵੇ ਹੋਣ ਹੋ ਗਏ ਹਨ ਉਨ੍ਹਾਂ ਕਰਕੇ ਉਨ੍ਹਾਂ ਚੀਜ਼ਾਂ ਵਾਸਤੇ ਅਤੇ ਹੋਰ ਹੋਰ ਤੋਂ ਹੋਰ ਉਹ ਆਪਣੀ ਗਾਰਡਨਿੰਗ ਵਗੈਰਾ ਵੀ ਕਰਦੇ ਹੈ ਘਰ ਤਾਂ ਕਿ ਉਨ੍ਹਾਂ ਦਾ ਆਸ ਪਾਸ ਦਾ ਮੌਸਮ ਵੀ ਸਹੀ ਰਹੇ